ਹੈਲੋ ਹਾਂਜੀ ਫਲਿੱਪਕਾਰਟ ਤੋਂ ਬੋਲ ਰਹੇ ਹੋ ਮੈਂ ਨਾ ਇੱਕ ਆਪਣਾ ਰਿਵਿਊ ਦੇਣਾ ਸੀਗਾ ਮੈਂ ਤੁਹਾਡੇ ਤੋਂ ਪ੍ਰੋਡਕਟ ਖਰੀਦਿਆ ਸੀਗਾ ਮੋਬਾਇਲ ਫ਼ੋਨ ਖਰੀਦਿਆ ਸੀਗਾ ਰੀਅਲਮੀ ਐਕਸ ਟੀ ਕਰਕੇ ਮੋਡਲ ਸੀਗਾ ਅਤੇ ਉਹ ਮੈਨੂੰ ਬਹੁਤ ਵਧੀਆ ਲੱਗਿਆ ਪ੍ਰੋਡਕਟ ਅਤੇ ਜਿਵੇਂ ਉਹ ਕੁਆਲਿਟੀ ਵਾਈਜ਼ ਤਾਂ ਹੈ ਹੀ ਸੀਗਾ ਵਧੀਆ ਬਾਕੀ ਤੁਸੀਂ ਜੋ ਉਹਦੀ ਉੱਥੇ ਕੰਪੈਰੀਜ਼ਨ ਕਰਕੇ ਦਿਖਾਇਆ ਹੋਇਆ ਸੀਗਾ ਉਸ ਤਰ੍ਹਾਂ ਹੀ ਨਿਕਲਿਆ ਤੁਸੀਂ ਬੜਾ ਵਧੀਆ ਤਰੀਕੇ ਨਾਲ਼ ਉੱਥੇ ਦੱਸਿਆ ਹੋਇਆ ਸੀਗਾ ਕਿ ਇਹਦੇ ਵਿੱਚ ਜੋ ਪ੍ਰੈ ਪ੍ਰੋਸੈਸਰ ਲੱਗਿਆ ਹੋਇਆ ਠੀਕ ਹੈ ਉਹਦੀ ਰੈਮ ਦੇ ਰੋਮ ਵਗੈਰਾ ਸਾਰਾ ਉਹ ਸਾਰੇ ਬਾਕੀ ਦੇ ਪ੍ਰੋਡਕਟਸ ਨਾਲ਼ ਕੰਪੈਰੀਜ਼ਨ ਕਰਕੇ ਮੈਂ ਲਿੱਤਾ ਸੀ ਅਤੇ ਮੈਨੂੰ ਲੱਗਿਆ ਕਿ ਸ਼ਾਇਦ ਕਿ ਜੋ ਦਿਖਾਇਆ ਗਿਆ ਉਹ ਨਾ ਹੋਵੇ ਪਰ ਮੈਨੂੰ ਬਹੁਤ ਵਧੀਆ ਐਕਸਪੀਰੀਅੰਸ ਲੱਗਿਆ ਉਹਦਾ ਅਤੇ ਪਰਫੋਰਮੈਂਸ ਬਹੁਤ ਅੱਛੀ ਹੈ ਅਤੇ ਬੈਟਰੀ ਲਾਈਫ਼ ਬਹੁਤ ਵਧੀਆ ਮਤਲਬ ਕਿ ਮੈਂ ਇੱਕ ਦਿਨ ਚਾਰਜ ਕਰਦਾ ਮੇਰਾ ਆਰਾਮ ਨਾਲ਼ ਅਗਲੇ ਦਿਨ ਤੱਕ ਵੀ ਥੋੜ੍ਹਾ ਟਾਈਮ ਕੱਢ ਜਾਂਦਾ ਉਹ ਫ਼ੋਨ ਅਤੇ ਬਾਕੀ ਪਰਫੋਰਮੈਂਸ ਵਾਈਜ਼ ਜੇ ਕਹਾਂ ਐਪਲੀਕੇਸ਼ਨ ਬੜੀ ਸਮੂਥਲੀ ਰਨ ਕਰਦੀਆਂ ਨੇ ਮਤਲਬ ਕੋਈ ਦਿੱਕਤ ਨਹੀਂ ਆਉਂਦੀ ਮਲਟੀਪਲ ਐਪਲੀਕੇਸ਼ਨ ਮੈਂ ਚਲਾ ਲੈਂਦਾ ਇੱਕ ਟਾਈਮ ਦੇ ਉੱਤੇ ਅਦਰਵਾਈਜ਼ ਪੁਰਾਣਾ ਮੋਬਾਇਲ ਸੀਗਾ ਜਿਹੜਾ ਬੜਾ ਲੈਕ ਕਰਦਾ ਸੀਗਾ ਅਤੇ ਇਹਦੇ ਵਿੱਚ ਮੈਨੂੰ ਐਕਸਪੀਰੀਅੰਸ ਇਹ ਬੜਾ ਵਧੀਆ ਲੱਗਿਆ ਕਿ ਜਿਵੇਂ ਤੁਸੀਂ ਪ੍ਰੋਸੈਸਰ ਦਾ ਕਿਹਾ ਸੀਗਾ ਕਿ ਇੰਨਾ ਫਾਸਟ ਹੈ ਅਤੇ ਉਵੇਂ ਹੀ ਕੰਮ ਕਰ ਰਿਹਾ ਅਤੇ ਥੈਂਕ ਯੂ ਸੋ ਮੱਚ ਐਨਾ ਵਧੀਆ ਮੈਨੂੰ ਪ੍ਰੋਡਕਟ ਦੇਣ ਦੇ ਲਈ